ਅੰਡੇ ਦੇਣ ਵਾਲੀਆਂ ਮੁਰਗੀਆਂ ਦਾ ਬਹੁਤ ਸਾਰਾ ਧਿਆਨ ਰੱਖਣਾ ਪੈਂਦਾ ਹੈ ਗਰਮੀ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਨੂੰ ਸਥਾਨ ਨੂੰ ਠੰਡਾ ਰੱਖਣ ਲਈ ਪੱਖੇ ਆਦਿ ਦੀ ਸੁਵਿਧਾ ਕਰਨੀ ਪੈਂਦੀ ਹੈ ਸਰਦੀ ਦੇ ਵਿੱਚ ਉਹਨਾਂ ਨੂੰ ਜਾਲੀਆਂ ਨੂੰ ਢੱਕਣਾ ਪੈਂਦਾ ਹੈ ਬਾਹਰ ਪਲਾਸਟਿਕ ਦੀਆਂ ਸ਼ੀਟਾਂ ਨਾਲ ਉਹਨਾਂ ਨੂੰ ਕਵਰ ਕਰਨਾ ਪੈਂਦਾ ਹੈ ਉਹਨਾਂ ਨੂੰ ਹੀਟ ਦੇਣ ਲਈ ਵਿੱਚ ਬਲਬ ਲਾਉਣਾ ਪੈਂਦਾ ਹੈ ਸਮੇਂ ਸਮੇਂ 'ਤੇ ਉਹਨਾਂ ਨੂੰ ਪ੍ਰੋਪਰ ਫੀਡ ਦੇਣੀ ਪੈਂਦੀ ਹੈ ਚੰਗੀ ਕੁਆਲਿਟੀ ਦਾਰ ਫੀਡ ਜਾਂ ਘਰ ਦੇ ਵਿੱਚ ਤਿਆਰ ਕਰਕੇ ਵਧੀਆ ਸ ਰਿਸ਼ਟ ਪੁਸ਼ਟ ਫੀਡ ਦੇਣੀ ਪੈਂਦੀ ਹੈ ਉਹਨਾਂ ਨੂੰ ਲਸਣ ਵਗੈਰਾ ਪਾਉਣਾ ਪੈਂਦਾ ਹੈ ਕਿ ਵੱਧ ਤੋਂ ਵੱਧ ਆਂਡੇ ਦੇਣ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਪੈਂਦਾ ਹੈ ਉਹਨਾਂ ਨੂੰ ਬੂੰਦਾਂ ਵਾਲੀ ਦਵਾਈ ਪਾਣੀ ਰਾਹੀਂ ਦੇਣੀ ਪੈਂਦੀ ਹੈ ਇਸ ਕਰਕੇ ਬੜਾ ਸਾਰਾ ਧਿਆਨ ਦੇਣਾ ਪੈਂਦਾ ਕਿ ਮੁਰਗੀਆਂ ਦੀ ਗੁਣਵੱਤਾ ਕਿਵੇਂ ਵਧਾਈ ਜਾ ਸਕੇ ਅਤੇ ਵੱਧ ਤੋਂ ਵੱਧ ਅੰਡੇ ਕਿਵੇਂ ਲਏ ਜਾ ਸਕਣ